ਮੇਰੇ ਮਨਪਸੰਦ ਅਧਿਆਪਕ ਮੇਰੀ ਟੀਚਰ ਮੇਰੀ ਇੰਚਾਰਜ ਗੁਰਪ੍ਰੀਤ ਕੌਰ ਮੈਡਮ ਸੀ ਜਿਹਨਾਂ ਨੇ ਮੈਨੂੰ ਹਿਸਟਰੀ ਬਾਰੇ ਗਿਆਨ ਦਿੱਤਾ ਉਹ ਮੈਨੂੰ ਹਿਸਟਰੀ ਦਾ ਸਿਲੇਬਸ ਪੜ੍ਹਾਉਂਦੇ ਸਨ ਹਿਸਟਰੀ ਬਾਰੇ ਨੌਲੇਜ ਮੈਨੂੰ ਗੁਰਪ੍ਰੀਤ ਮੈਡਮ ਤੋਂ ਮਿਲੀ ਹੈ ਮੇਰੇ ਟੀਚਰ ਫੇਵਰੇਟ ਟੀਚਰ ਸੀ ਗੁਰਪ੍ਰੀਤ ਮੈਡਮ ਅਤੇ ਉਹਨਾਂ ਨੇ ਮੈਨੂੰ ਹਿਸਟਰੀ ਬਾਰੇ ਦੱਸਿਆ ਕਿ ਆਪਣਾ ਇਤਿਹਾਸ ਕੀ ਸੀ ਗੁਰੂ ਗੋਬਿੰਦ ਸਿੰਘ ਜੀ ਕਿਉਂ ਕੌਣ ਸਨ ਉਹਨਾਂ ਦੇ ਚਾਰ ਬੱਚੇ ਕੌਣ ਸਨ ਪੁੱਤਰ ਕੌਣ ਸਨ ਉਹਨਾਂ ਦੇ ਗੁਰਪ੍ਰੀਤ ਮੈਡਮ ਨੇ ਮੈਨੂੰ ਇਤਿਹਾਸ ਬਾਰੇ ਨੌਲੇਜ ਦਿੱਤੀ ਹੈ ਅੱਜ ਜੋ ਵੀ ਮੈਂ ਹਾਂ ਸਿੱਖੀ ਦੇ ਰਾਹ ਉਤੇ ਚੱਲ ਰਹੀ ਹਾਂ ਸਿਰਫ਼ ਉਹਨਾਂ ਦੀ ਹੀ ਬਦੌਲਤ ਹੈ ਅੱਜ ਜੋ ਮੈਂ ਇੰਨੇ ਐਡੀ ਵੱਡੀਆਂ ਸਟੇਜਾਂ ਦੇ ਉੱਤੇ ਖੜ੍ਹ ਕੇ ਇਤਿਹਾਸ ਬੋਲਦੀ ਹਾਂ ਸਿਰਫ਼ ਮੇਰੀ ਟੀਚਰ ਗੁਰਪ੍ਰੀਤ ਕੌਰ ਮੈਡਮ ਦਾ ਹੀ ਮੇਰੇ ਸਿਰ ਉੱਤੇ ਹੱਥ ਹੈ ਜੇਕਰ ਅੱਜ ਕੱਲ੍ਹ ਆਪਾਂ ਗੁਰੂਆਂ ਬਾਰੇ ਗੱਲ ਕਰੀਏ ਤਾਂ ਸਭ ਤੋਂ ਵੱਡੇ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਨ ਜਿਹਨਾਂ ਨੇ ਆਪਣੇ ਇਸ ਦੁਨੀਆਂ ਖਾਤਰ ਸੰਸਾਰ ਦੇ ਲਈ ਆਪਣੇ ਚਾਰ ਪੁੱਤਰ ਕੁਰਬਾਨ ਕੀਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਨੌਲੇਜ ਮੈਨੂੰ ਮੇਰੀ ਮੈਡਮ ਗੁਰਪ੍ਰੀਤ ਕੌਰ ਨੇ ਹੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਕੌਣ ਸਨ ਆਪਣਾ ਇਤਿਹਾਸ ਕੀ ਸੀ ਆਪਣੇ ਇਤਿਹਾਸ ਵਿੱਚ ਕੀ ਸੀ ਕੀ ਨਹੀਂ ਸੀ ਚੰਗਾ ਮਾੜਾ ਜੋ ਵੀ ਹੁਣ ਤੱਕ ਹੋ ਰਿਹਾ ਉਹ ਸਾਰਾ ਉਹਨਾਂ ਦੀ ਹੀ ਕਿਰਪਾ ਨਾਲ ਹੋਇਆ ਅੱਜ ਜੋ ਵੀ ਮੈਂ ਐਡੇ ਐਡੇ ਸਟੇਜਾਂ 'ਤੇ ਖੜ੍ਹੀ ਹਾਂ ਚੰਗੀ ਹਾਂ ਮਾੜੀ ਹਾਂ ਸਿਰਫ਼ ਉਹਨਾਂ ਦੀ ਹੀ ਕਿਰਪਾ ਦੇ ਨਾਲ ਹਾਂ ਮੈਂ ਧੰਨਵਾਦ ਕਰਦੀ ਹਾਂ ਮੇਰੀ ਗੁਰਪ੍ਰੀਤ ਮੈਡਮ ਦਾ ਜੋ ਅੱਜ ਅੱਜ ਦੇ ਮਾਹੌਲ ਦੇ ਵਿੱਚ ਬੇ ਬੇਸ਼ੱਕ ਮੇਰੇ ਨਾਲ ਨਹੀਂ ਹਨ ਪਰ ਮੈਨੂੰ ਉਹ ਟਾਈਮ ਅੱਜ ਵੀ ਯਾਦ ਹੈ